ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂਜੀ ਹਾਂਜੀ ਹਾਂਜੀ ਪੁੱਛੋ ਹਾਂਜੀ ਇੱਥੇ ਸਾਡੇ ਸੰਥਿਆ ਕਰਵਾਈ ਜਾਂਦੀ ਆ ਹਾਂਜੀ ਜਿਵੇਂ ਨਿਤਨੇਮ ਹੋ ਗਿਆ ਸੁਖਮਨੀ ਸਾਹਿਬ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੋਰ ਬਾਣੀਆਂ ਦੀ ਵੀ ਸੰਥਿਆ ਕਰਵਾਈ ਜਾਂਦੀ ਆ ਹਾਂਜੀ ਇਹ ਬੱਚਿਆਂ ਨੂੰ ਸੁਬਾ ਵੀ ਕਰਵਾਈ ਜਾਂਦੀ ਹੈ ਜਿਵੇਂ ਅੱਠ ਤੋਂ ਲੈ ਕੇ ਦਸ ਵਜੇ ਤੱਕ ਫਿਰ ਸ਼ਾਮ ਨੂੰ ਵੀ ਕਾਰਵਾਈ ਜਾਂਦੀ ਹੈ ਰਹਿਰਾਸ ਟਾਈਮ ਛੇ ਤੋਂ ਲੈ ਕੇ ਅੱਠ ਵਜੇ ਤੱਕ ਹਾਂਜੀ ਹਾਂਜੀ ਜਿਵੇਂ ਬੀਬੀਆਂ ਵਾਸਤੇ ਤਾਂ ਸਲਵਾਰ ਸੂਟ ਸਿਰ ਢੱਕ ਕੇ ਆਉਣਾ ਚੁੰਨੀ ਲੈ ਚੁੰਨੀ ਲੈ ਸਕਦੇ ਹਾਂ ਜਾਂ ਦਸਤਾਰ ਬੰਨ੍ਹ ਸਕਦੇ ਹਾਂ ਹਾਂਜੀ ਮੁੰਡਿਆਂ ਵਾਸਤੇ ਕੁੜਤਾ ਪਜਾਮਾ ਜਾਂ ਪਟਕਾ ਬੰਨ੍ਹ ਸਕਦੇ ਹਾਂ ਜਾਂ ਦਸਤਾਰ ਸਜਾ ਸਕਦੇ ਹਾਂ ਹਾਂਜੀ ਉਹ ਕੋਈ ਪ੍ਰੋਬਲਮ ਨਹੀਂ ਆ ਉਹ ਜਿਵੇਂ ਵੀ ਬਸ ਸਾਬਤ ਸੂਰਤ ਹੋਣਾ ਚਾਹੀਦਾ ਬੱਚਾ ਹਾਂਜੀ ਹਾਂਜੀ ਸੰਥਿਆ ਤੋਂ ਇਲਾਵਾ ਹੋਰ ਵੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਗੁਰੂਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਗੁਰੂਆਂ ਦੇ ਇਤਿਹਾਸ ਬਾਰੇ ਜੀਵਨੀ ਬਾਰੇ ਸਭ ਕੁਝ ਦੱਸਿਆ ਜਾਂਦਾ ਵਾ ਹਾਂਜੀ ਹਾਂਜੀ ਇਹ ਕੋਈ ਹੈ ਨਹੀਂ ਗਾ ਮਤਲਬ ਕਿ ਛੋਟੇ ਤੋਂ ਛੋਟਾ ਬੱਚਾ ਵੀ ਆ ਸਕਦਾ ਕਿਉਂਕਿ ਜੇ ਆਪਾਂ ਛੋਟੇ ਬੱਚੇ ਨੂੰ ਕਿਸੇ ਚੀਜ਼ ਬਾਰੇ ਸਮਝਾਵਾਂਗੇ ਤਾਂ ਹੌਲੀ ਹੌਲੀ ਇਸ ਬਾਰੇ ਸਮਝੇਗਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ